ਖੁੱਲੇ ਪਾਣੇ ਵਿੱਚ ਤੈਰਾਕੀ ਕਰਦੇ ਸਮੇਂ ਸਾਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਸਾਨੂੰ ਦਲਦਲ ਵਾਲੀ ਜਗ੍ਹਾ ਨਹੀਂ ਜਾਣਾ ਚਾਹੀਦਾ ਹੈ ਤਿਲਕਣ ਪਾਣੀ ਵਿੱਚ ਕਾਫੀ ਤਿਲਕਣ ਹੋਣ 'ਤੇ ਸਾਨੂੰ ਸੱਟ ਵੀ ਲੱਗ ਸਕਦੀ ਹੈ ਇਸ ਕਰਕੇ ਸਾਨੂੰ ਪਾਣੀ ਵਿੱਚ ਤੈਰਾਕੀ ਤੈਰਾਈ ਕਰਨ ਸਮੇਂ ਸਾਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਅਤੇ ਜਿੱਥੇ ਤੇਜ਼ ਵਹਾ ਹੋਵੇ ਉੱਥੇ ਵੀ ਸਾਨੂੰ ਨਹੀਂ ਜਾਣਾ ਚਾਹੀਦਾ ਹੈ ਪਾਣੀ ਡੂੰਘੇ ਪਾਣੀ ਵਿੱਚ ਕਈ ਜੀਵ ਜੰਤੂ ਹੁੰਦੇ ਹਨ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਸ ਪਾਣੀ ਵਿੱਚ ਤੈਰਾਕੀ ਕਰਨੀ ਚਾਹੀਦੀ ਹੈ